ਸਕੂਲ ਵਿੱਚ ਬੱਚਿਆਂ ਨੂੰ ਕਰਜ਼ੇ ਅਤੇ ਰਿਟਰਨ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਾ ਇਹ ਵਾਧਾ ਹੈ ਕਿ ਜੇ ਇਹਨਾਂ ਨੂੰ ਇਹ ਸਾਰੀ ਜਾਣਕਾਰੀ ਹੋਵੇਗੀ ਤਾਂ ਇਹ ਵੱਡੀ ਪੱਧਰ 'ਤੇ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਨੇ ਜਾਂ ਕਰਜ਼ੇ ਦੀ ਲੋੜ ਹੈ ਤਾਂ ਕਰਜ਼ਾ ਲੈਣਾ ਚਾਹੁੰਦੇ ਨੇ ਇਹ ਕਿੱਦਾਂ ਲੱਗਦਾ ਕਿੱਦਾਂ ਇਹਨਾਂ ਦੀਆਂ ਕਿਸ਼ਤਾਂ ਭਰੀ ਦੀਆਂ ਇਹ ਸਾਰਾ ਜਾਨਣਾ ਇਹਨਾਂ ਨੂੰ ਜ਼ਰੂਰੀ ਹੈ ਰਿਟਰਨ ਰਿਟਰਨ ਇੱਦਾਂ ਹੈ ਵੀ ਜਿੱਦਾਂ ਟੈਕਸ ਭਰਦੇ ਹਾਂ ਆਪਣੀ ਇਨਕਮ ਟੈਕਸ ਹੋ ਗਿਆ ਜਾਂ ਹੋਰ ਹੈ ਇਹਨੂੰ ਆਪਣੀਆਂ ਭਰਨਾ ਜ਼ਰੂਰੀ ਹੁੰਦਾ ਹੈ ਅਤੇ ਇਹਦੇ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਕਈ ਵਾਰ ਕੀ ਹੁੰਦਾ ਲੋਕ ਕਰਜ਼ਾ ਲੈ ਲੈਂਦੇ ਪਰ ਸਮੇਂ ਸਿਰ ਕਿਸ਼ਤ ਨਹੀਂ ਉਤਾਰਦੇ ਉਹਦਾ ਨੁਕਸਾਨ ਇਹ ਹੁੰਦਾ ਕਿ ਜੋ ਵੀ ਉਹਨਾਂ ਨੇ ਚੀਜ਼ 'ਤੇ ਕਰਜ਼ਾ ਲਿਆ ਹੁੰਦਾ ਉਹ ਚੀਜ਼ ਵੀ ਚਲ ਜਾਂਦੀ ਹੈ ਅਤੇ ਹੱਥ ਕੁਛ ਵੀ ਨਹੀਂ ਰਹਿ ਜਾਂਦਾ ਇਸ ਕਰਕੇ ਹਰ ਇੱਕ ਬੱਚੇ ਨੂੰ ਕਰਜ਼ੇ ਦੀ ਜਾਣਕਾਰੀ ਕਿੱਦਾਂ ਕਰਜ਼ਾ ਲੈਣਾ ਹੈ ਕਿੱਦਾਂ ਉਤਾਰਨਾ ਹੈ ਰਿਟਰਨ ਭਰਨੀ ਇਹ ਸਾਰਾ ਆਉਣਾ ਬਹੁਤ ਜ਼ਰੂਰੀ ਹੈ